ਪਿੰਡ ਵਿਚ ਘਰ ਬਣਾਉਣ ਵੇਲੇ ਅਸੀਂ ਧਿਆਨ ਦੇਵਾਂਗੇ ਵੀ ਮੌਸਮ ਕਿਵੇਂ ਦਾ ਆ ਕਿ ਉਹ ਮੌਸਮ ਮਤਲਬ ਜ਼ਿਆਦਾ ਗਰਮੀ ਵੀ ਨਾ ਹੋਵੇ ਜ਼ਿਆਦਾ ਠੰਡ ਵੀ ਨਾ ਹੋਵੇ ਠੀਕ ਠੀਕ ਮੌਸਮ ਹੋਵੇ ਤਾਂ ਜੋ ਕੰਮ ਵਧੀਆ ਤਰੀਕੇ ਨਾਲ ਕਰ ਸਕੀਏ ਮੀਂਹ ਬਾਰਿਸ਼ ਦਾ ਮੌਸਮ ਨਾ ਹੋਵੇ ਉਦੋਂ ਮੌਸਮ ਵੱਲ ਧਿਆਨ ਦੇਣਾ ਚਾਹੀਦਾ ਆ ਵਸਤੂਆਂ ਕਿਹੜੀਆਂ ਕਿਹੜੀਆਂ ਵਸਤੂਆਂ ਸਾਨੂੰ ਚਾਹੀਦੀਆਂ ਨੇਗੀਆਂ ਇੱਟ ਸੀਮਿੰਟ ਰੇਤਾਂ ਬਜਰੀ ਉਹਨਾਂ ਦਾ ਸਹੀ ਸਮੇਂ 'ਤੇ ਉਪਲਬਧੀ ਹੋਣੀ ਚਾਹੀਦੀ ਆ ਟਾਈਮ ਟੂ ਟਾਈਮ ਹਰ ਇੱਕ ਚੀਜ਼ ਹੋਣੀ ਚਾਹੀਦੀ ਆ ਅਤੇ ਜਿਹੜੇ ਮਿਸਤਰੀ ਨੇ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਅਤੇ ਅਸੀਂ ਜਿਹੜਾ ਕੰਮ ਕਰਦੇ ਹਾਂ ਸਾਡੇ ਕੰਮ 'ਤੇ ਵੀ ਕੋਈ ਇਫੈਕਟ ਨਾ ਪਵੇ ਕਿਉਂਕਿ ਜਿਹੜੇ ਅਸੀਂ ਮਿਸਤਰੀ ਲਾਏ ਨੇਗੇ ਉਹ ਸਾਰਾ ਕੰਮ ਆਪਣਾ ਸਮੇਂ ਸਿਰ ਕਰਦੇ ਰਹਿਣ ਤਾਂ ਜੋ ਸਾਡੇ ਘਰ ਦੇ ਜਿਹੜੇ ਮੈਂਬਰ ਨੇ ਬਾਹਰ ਨੌਕਰੀਆਂ ਕਰਦੇ ਨੇਗੇ ਉਹਨਾਂ ਨੂੰ ਕੋਈ ਉਹਨਾਂ 'ਤੇ ਕੋਈ ਅਸਰ ਨਾ ਪਵੇ ਉਹ ਆਪਣਾ ਕੰਮ ਸ਼ਾਮ ਤੱਕ ਦੇਖ ਲੈਣ ਸਵੇਰੇ ਦੇਖ ਲੈਣ ਅਤੇ ਬਾਕੀ ਹੋਰ ਤਾਂ ਕਿ ਹੋਰ ਤਾਂ ਘਰ ਦਾ ਡਿਜ਼ਾਈਨ ਹੀ ਦੇਖਣਾ ਹੁੰਦਾ ਏ ਆ ਵੀ ਰਸੋਈ ਕਿੱਥੇ ਹੋਣੀ ਚਾਹੀਦੀ ਆ ਕਿਚਨ ਸਾਡੀ ਕਿੱਥੇ ਹੋਣੀ ਚਾਹੀਦੀ ਆ ਲੋਬੀ ਕਿੱਥੇ ਹੋਣੀ ਚਾਹੀਦੀ ਆ ਇੱਕ ਵਧੀਆ ਤਰੀਕੇ ਨਾਲ ਘਰ ਦਾ ਨਕਸ਼ਾ ਤਿਆਰ ਹੋਣਾ ਚਾਹੀਦਾ ਤਾਂ ਜੋ ਸਾਡਾ ਘਰ ਸਾਨੂੰ ਵਧੀਆ ਲੱਗੇ ਅਤੇ ਅਸੀਂ ਜਿਵੇਂ ਦਾ ਸੋਚਿਆ ਉਵੇਂ ਦਾ ਬਣੇ ਹਾਲ ਦੇ ਵਿੱਚ ਪਹਿਲਾਂ ਦੋ ਕੁ ਸਾਲ ਪਹਿਲਾਂ ਤਾਂ ਇਹ ਸੀਗਾ ਵੀ ਦੋ ਕੁ ਸਾਲ ਪਹਿਲਾਂ ਕਿ ਉਹ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਐਵੇਂ ਸੀਗਾ ਵੀ ਹਾਂ ਬਿਨਾਂ ਨਕਸ਼ੇ ਤੋਂ ਘਰ ਬਣ ਜਾਂਦਾ ਸੀ ਪਰ ਹੁਣ ਦੋ ਸਾਲਾਂ ਦੇ ਵਿੱਚ ਇੰਨਾਂ ਕੁ ਚੇਂਜ ਹੋ ਗਿਆ ਛ ਥੋੜ੍ਹੀ ਜਿਹੀ ਜਗ੍ਹਾ ਲਈ ਵੀ ਅਗਰ ਕੋ ਦੋ ਕੁ ਵਿਸਵੇ ਜਗ੍ਹਾ ਵੀ ਆ ਤਾਂ ਉਹਨੂੰ ਪਾਉਣ ਲਈ ਵੀ ਇੱਕ ਪ੍ਰੋਪਰ ਨਕਸ਼ਾ ਤਿਆਰ ਕੀਤਾ ਜਾਂਦਾ ਨਕਸ਼ੇ ਦੇ ਅਨੁਸਾਰ ਸਾਰਾ ਘਰ ਤਿਆਰ ਕੀਤਾ ਜਾਂਦਾ ਹੈਗਾ